ਜੇ ਅਸੀਂ ਅੱਜ ਦੇ ਸਿੱਖਿਆ ਨੂੰ ਮਤਲਬ ਅੱਜ ਦੀ ਸਿੱਖਿਆ ਕੇਂਦਰਾਂ ਨੂੰ ਦੂਸ ਪੁਰਾਣੇ ਸਿੱਖਿਆ ਕੇਂਦਰਾਂ ਨਾਲ ਜੇ ਕੰਪੇਅਰ ਕਰੀਏ ਅਤੇ ਉਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਮੇਰੇ ਮੰਮੀ ਪਾਪਾ ਨੇ ਜਾਂ ਦਾਦਾ ਦਾਦੀ ਨੇ ਉਹਨਾਂ ਕੋਲ ਇੰਨੇ ਜ਼ਿਆਦਾ ਸੋਰਸ ਨਹੀਂ ਹੈਗੇ ਸੀਗੇ ਪੜ੍ਹਨ ਦੀ ਉਸ ਟਾਈਮ 'ਤੇ ਸਕੂਲ ਕਾਲਜ ਵੀ ਇੰਨੇ ਜ਼ਿਆਦਾ ਨਹੀਂ ਸੀਗੇ ਅਤੇ ਨਾ ਹੀ ਉਹਨਾਂ ਕੋਲ ਕੋਈ ਐਸਾ ਬੰਦਾ ਹੁੰਦਾ ਸੀ ਜਿਹੜਾ ਉਹਨਾਂ ਨੂੰ ਸਮਝਾ ਸਕੇ ਕੀ ਵੀ ਹਾਂ ਤੁਸੀਂ ਕਾਲਜ ਜਾਓ ਜਾਂ ਸਕੂਲ ਜਾਓ ਜਾਂ ਕਿਸੇ ਨਾਲ ਤੁਸੀਂ ਗਰੋ ਕਰ ਸਕਦੇ ਹੋ ਉਹਨਾਂ ਨੂੰ ਮਤਲਬ ਨੋਰਮਲ ਦਸਵੀਂ ਬਾਰਵੀਂ ਤੱਕ ਪੜ੍ਹਾਉਂਦੇ ਸੀ ਅਤੇ ਉਸ ਤੋਂ ਬਾਅਦ ਉਹ ਕੋਈ ਨਾ ਕੋਈ ਕੰਮ ਮਤਲਬ ਕੰਮ ਕੁੰਮ ਕਰਨ ਲੱਗ ਜਾਂਦੇ ਸੀ ਅਤੇ ਬਸ ਇੰਨਾ ਹੀ ਹੁੰਦਾ ਸੀ ਅਤੇ ਔਰਤਾਂ ਨੂੰ ਬੇਸਿਕਲੀ ਇਹੀ ਕਰਦੇ ਸੀ ਕਿ ਦਸਵੀਂ ਕਰ ਲਈ ਬਾਰਵੀਂ ਕਰ ਲਈ ਅਤੇ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਪਾ ਦਿੱਤਾ ਜਾਂਦਾ ਸੀ ਲੇਕਿਨ ਅੱਜ ਕੱਲ੍ਹ ਜਿਹੜਾ ਉਹ ਲੋਕਾਂ ਦਾ ਜਿਹੜਾ ਮਾਇੰਡ ਸੈਟ ਆ ਉਹ ਬੜਾ ਚੇਂਜ ਹੋ ਗਿਆ ਵਾ ਹਾਂ ਕੋਈ ਲੋਕ ਆਪਣੀਆਂ ਕੁੜੀਆਂ ਨੂੰ ਵੀ ਪੜ੍ਹਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਡੀਆਂ ਕੁੜੀਆਂ ਵੀ ਪੜ੍ਹਨ ਲੇਕਿਨ ਪਹਿਲੇ ਟਾਈਮ ਦੇ ਉੱਤੇ ਕੁੜੀਆਂ ਨੂੰ ਬਹੁਤ ਜ਼ਿਆਦਾ ਮਤਲਬ ਘਰਾਂ ਦੇ ਅੰਦਰ ਵਾੜ ਕੇ ਰੱਖਿਆ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਨਹੀਂ ਇਹਨਾਂ ਨੂੰ ਬਾਹਰ ਨਹੀਂ ਭੇਜਣਾ ਮਤਲਬ ਉਹਨਾਂ 'ਤੇ ਕਾਫੀ ਜ਼ਿਆਦਾ ਰਿਸਟ੍ਰਿਕਸ਼ਨਸ ਲਗਾਈਆਂ ਜਾ ਰਹੀਆਂ ਸੀ ਅਤੇ ਹੁਣ ਦੀ ਜਾਂਦੀਆਂ ਸੀ ਤੇ ਲੇਕਿਨ ਅੱਜ ਕੱਲ੍ਹ ਜਿਹੜੀਆਂ ਉਹ ਕੋਈ ਇੱਦਾਂ ਦੀ ਰਿਸਟ੍ਰਿਕਸ਼ਨ ਜਿਹੜੀ ਆ ਉਹ ਨਹੀਂ ਲਗਾਈ ਜਾਂਦੀ ਅੱਜ ਕੱਲ੍ਹ ਕਾਫੀ ਜ਼ਿਆਦਾ ਮਾਡਰਨਾਈਜੇਸ਼ਨ ਹੋ ਗਈ ਹੈ ਲੋਕ ਪੜ੍ਹਨਾ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ ਕੁੜੀਆਂ ਨੂੰ ਖ਼ਾਸ ਕਰਕੇ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਪੜ੍ਹਾ ਰਹੇ ਨੇ ਈਵਨ ਸਰਕਾਰ ਬਹੁਤ ਜ਼ਿਆਦਾ ਅ ਜਿਹੜੀ ਆ ਉਹ ਐਫਰਟਸ ਚੱਲ ਰਹੀ ਹੈ ਕਿ ਵੀ ਜਿਹੜੀਆਂ ਕੁੜੀਆਂ ਨੇ ਉਹ ਅੱਗੇ ਵੱਧ ਸਕਣ ਤੇ ਜਿਹੜੇ ਓਦਾਂ ਦੂਸਰੀ ਸਾਈਡ ਜੇ ਆਪਾਂ ਲੜਕਿਆਂ ਦੀ ਗੱਲ ਕਰੀਏ ਤਾਂ ਲੜਕੇ ਵੀ ਪਹਿਲਾਂ ਮਤਲਬ ਹੁੰਦਾ ਸੀਗਾ ਉਹਨਾਂ ਦੀ ਆਪਣੇ ਫਾਰਮਰ ਵਗੈਰਾ ਹੁੰਦੇ ਸੀ ਖੇਤ ਖੂਤ ਹੁੰਦੇ ਸੀ ਅਤੇ ਉੱਥੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਸੀ ਅਤੇ ਨੌਕਰੀਆਂ ਬੜੇ ਘੱਟ ਲੋਕ ਹੁੰਦੇ ਸੀ ਮਤਲਬ ਦਸ ਦੇ ਪਿੱਛੇ ਸਿਰਫ ਦੋ ਤਿੰਨ ਲੋਕ ਹੋਣਗੇ ਜਿਹੜੇ ਨੌਕਰੀਆਂ ਵੱਲ ਜਾਂਦੇ ਸੀ ਲੇਕਿਨ ਅੱਜ ਕੱਲ੍ਹ ਕਾਫੀ ਬੱਚਿਆਂ ਦਾ ਜਿਹੜਾ ਉਹ ਅ ਦੂਸਰਿਆਂ ਨਾਲ ਮਿਲ ਕੇ ਦੂਸਰੇ ਨਾਲ ਗੱਲ ਕਰਕੇ